ਜੇ ਡਾਂਸਰਾ ਦਾ ਬੋਲੀਵੁੱਡ ਦੇ ਵਿੱਚ ਬਹੁਤ ਹੀ ਪ੍ਰਭਾਵ ਹੈ ਅੱਜ ਕੱਲ੍ਹ ਜੇ ਡਾਂਸਰ ਨਾ ਹੋਣ ਤਾਂ ਬੋਲੀਵੁੱਡ ਵਿੱਚ ਉਹਨਾਂ ਦੀ ਫਿਲਮਾਂ ਇੰਨੀਆਂ ਖ਼ਾਸ ਨਾ ਚੱਲਣ ਅੱਜ ਕੱਲ੍ਹ ਜਦੋਂ ਵੀ ਬੋਲੀਵੁੱਡ ਵਿੱਚ ਕੋਈ ਵੀ ਡਾਂਸ ਹੁੰਦਾ ਹੈ ਤਾਂ ਡਾਂਸਰਾਂ ਦਾ ਪਿੱਛੇ ਹੋਣਾ ਇੱਕ ਵੱਖਰਾ ਹੀ ਪ੍ਰਭਾਵ ਪਾਉਂਦਾ ਹੈ ਜਿਸ ਕਾਰਨ ਡਾਂਸਰਾਂ ਦੀ ਬਹੁਤ ਹੀ ਜ਼ਰੂਰਤ ਹੁੰਦੀ ਹੈ ਇਸ ਕਰਕੇ ਪੰਜ ਅੱਜ ਕੱਲ੍ਹ ਪੰਜਾਬੀ ਭੰਗੜਾ ਪੰਜਾਬੀ ਗਾਣੇ ਭਾਰਤ ਵਿੱਚ ਹਰ ਕਿਸੇ ਨੂੰ ਬਹੁਤ ਹੀ ਪਸੰਦ ਹਨ ਇਸੇ ਕਰਕੇ ਡਾਂਸਰਾਂ ਦੀ ਬੋਲੀਵੁੱਡ ਵਿੱਚ ਬਹੁਤ ਹੀ ਜ਼ਰੂਰਤ ਹੈ ਧੰਨਵਾਦ